ਦੋ ਜਨਵਰੀ ਉੱਨੀ ਸੌ ਪਚਾਨਵੇਂ ਬਾਰ੍ਹਾਂ ਮਾਰਚ ਉੱਨੀ ਸੌ ਇਕਾਨਵੇਂ ਚੌਦਾਂ ਜਨਵਰੀ ਉੱਨੀ ਸੌ ਛਿਆਨਵੇਂ ਛੇ ਜੂਨ ਉੱਨੀ ਸੌ ਨੱਬੇ ਸਤਾਰ੍ਹਾਂ ਅਪ੍ਰੈਲ ਉੱਨੀ ਸੌ ਛਿਆਨਵੇਂ